ਹੈਲੋ ਹਾਂਜੀ ਤੁਸੀਂ ਕਿੱਥੇ ਲਾਇਆ ਜੀ ਅਸੀਂ ਫਰਨੀਚਰ ਹਾਊਸ ਤੋਂ ਬੋਲਦੇ ਹਾਂ ਰੀਫ ਆਫ ਦੇਸ਼ ਸਾਡੇ ਕੋਲ ਪੁਰਾਣਾ ਫਰਨੀਚਰ ਮਤਲਬ ਨਵੇਂ ਵਰਗਾ ਹੁੰਦਾ ਸ਼ੋਪ ਤਾਂ ਕੋਈ ਨਾ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਹਾਂ ਲੁਧਿਆਣੇ ਆ ਨਿਊ ਵਰਗਾ ਹੀ ਹੁੰਦਾ ਜੀ ਇਹ ਮਤਲਬ ਤੁਸੀਂ ਦੱਸ ਨਹੀਂ ਸਕਦੇ ਹਾਂ

ਅਡਰੈੱਸ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਪੁੱਛੋ ਕੀ ਪੁੱਛਣਾ ਸਾਰਾ ਕੁਛ ਹੁੰਦਾ ਜੀ ਫਰਨੀਚਰ ਦੇ ਵਿੱਚ ਹਾਂਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਕੰਪਿਊਟਰ ਟੇਬਲ ਵੀ ਹੈਗਾ ਸਾਡੇ ਕੋਲ

ਹਾਂਜੀ ਹਾਂਜੀ ਠੀਕ ਆ ਜੀ ਆਪਣੇ ਕੋਲ ਸਭ ਕੁਛ ਹੈਗਾ ਤੁਸੀਂ ਵਿਜ਼ਿਟ ਕਰੋ ਦੇਖੋ ਰੇਟ ਦੇ ਹਿਸਾਬ ਨਾਲ ਸਮਾਨ ਥੱਲੇ ਤੋਂ ਲੈ ਕੇ ਉੱਪਰ ਤੱਕ ਜਿੰਨਾ ਕੁ ਤੁਸੀਂ ਲੈਣਾ ਉਹੋ ਜਿਹਾ ਪਿਆ ਆਪਣੇ ਹਾਂਜੀ ਤੁਸੀਂ ਇੱਕ ਵਾਰ ਆਓ ਅਤੇ ਦੇਖੋ

ਜ਼ਰੂਰ ਜ਼ਰੂਰ ਜੀ ਆਹ ਤਾਂ ਤੁਸੀਂ ਮੇਰੇ ਮੂੰਹ ਦੀ ਗੱਲ ਕੱਢ ਲਈ ਜੀ ਮੈਂ ਵੀ ਇਹ ਹੀ ਕਹਿਣ ਲੱਗਿਆ ਸੀ ਹਾਂਜੀ ਹਾਂਜੀ ਜ਼ਰੂਰ ਲੋਕੇਸ਼ਨ ਭੇਜ ਦਿੰਦੇ ਹਾਂ ਹਾਂਜੀ ਤੁਸੀਂ ਪਰਿਵਾਰ ਨਾਲ ਆਇਓ ਜੀ ਕੋਈ ਹੋਰ ਵੀ ਡਿਸਕਾਊਂਟ ਦੇਵਾਂਗੇ ਤੁਹਾਨੂੰ ਅਸੀਂ ਬਿਲਕੁਲ ਬਿਲਕੁਲ ਜੀ ਤੁਸੀਂ ਫਰਨੀਚਰ ਦੇ ਵਿੱਚ ਸਾਰਾ ਕੁਛ ਹੁੰਦਾ ਏ ਟੂ ਜੈਡ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਖੋਂਗੇ ਵੀ ਤੁਹਾਨੂੰ ਪਸੰਦ ਆਉਣਗੀਆਂ ਦੇਖ ਕੇ ਵੀ ਆਹ ਵੀ ਚੀਜ਼ ਹੁੰਦੀ ਆ ਹਾਂ ਸਾਡੇ ਕੋਲ ਮਸਾਜ ਵਾਲੇ ਵੀ ਹੈਗੇ ਨੇ ਜੀ

ਬਿਲਕੁਲ ਬਿਲਕੁਲ ਜੀ ਕਿਡਸ ਦੀਆਂ ਸਾਰਾ ਮੰਗਵਾ ਦਿਆਂਗੇ ਜੀ ਇਹੋ ਜਿਹਾ ਫਰਨੀਚਰ ਨੇ ਉਹਨਾਂ ਕੋਲ ਹੈਗੀ ਹੈਗੀ ਜੀ ਮੈਂ ਕਿਹਾ ਤੁਸੀਂ ਜਵਾਬ ਜਿਹੜਾ ਤੁਹਾਡੇ ਦਿਮਾਗ 'ਚ ਆ ਗਈ ਚੀਜ਼ ਉਹ ਆਪਣੇ ਕੋਲ ਹੈਗੀ ਆ ਤੁਸੀਂ ਆਓ ਫਿਰ ਕਿਤੇ ਕੋਈ ਨਾ ਟਾਈਮ ਕੱਢੋ ਸੰਡੇ ਵੀ ਓਪਨ ਹੁੰਦਾ ਆਪਣਾ ਹਾਂ ਤੁਸੀਂ ਜੇ ਕੱਲ੍ਹ ਫੋਨ ਕਰ ਲੈਂਦੇ ਸੈਕਿੰਡ ਸੈਚਰਡੇ ਵੀ ਓਪਨ ਸੀਗਾ ਨਾ ਤੁਹਾਡਾ ਆਫ ਹੁੰਦਾ ਉੱਥੇ ਬੈਂਕ 'ਚ ਨਾ ਬਿਲਕੁਲ ਬਿਲਕੁਲ ਬਿਲਕੁਲ ਜੀ ਹਾਂ ਤੁਸੀਂ ਉਹਨੂੰ ਲਾਈਕ ਅਤੇ ਸ਼ੇਅਰ ਕਰੋ ਮੇਰੀ ਉਹਨਾਂ ਨੂੰ ਵੀਡੀਓ ਨੂੰ ਤੇ ਹੋਰ ਵੀ ਡਿਸਕਾਊਂਟ ਦੇਵਾਂਗੇ ਤੁਹਾਨੂੰ ਅਸੀਂ ਹਾਂ ਹਾਂ ਪੇਜ ਸ਼ੇਅਰ ਕਰਕੇ ਆਓ ਤੁਹਾਨੂੰ ਹੋਰ ਵੀ ਡਿਸਕੋਂਟ ਦੇਵਾਂਗੇ ਤੁਹਾਨੂੰ ਸੋਫਿਆਂ ਦੇ ਕਵਰ ਫਰੀ ਦੇ ਦੇਵਾਂਗੇ ਹਾਂ ਹਾਂ ਜੇ ਫੇਮਲੀ ਫੈਮਲੀ ਲੈ ਕੇ ਆਓਂਗੇ ਤੁਹਾਨੂੰ ਮੇਜ ਦਾ ਉੱਪਰ ਵਿਛਾਉਣ ਵਾਲਾ ਕੱਪੜਾ ਵੀ ਫਰੀ ਹਾਂਜੀ ਹਾਂ ਹੈਂ ਹੈਂਜੀ ਹਾਂ ਹਾਂਜੀ ਹਾਂਜੀ ਤੁਸੀਂ ਆਓ ਫਿਰ ਇੱਕ ਵਾਰ ਸਭ ਕੁਛ ਹੁੰਦਾ ਜੀ ਦੇਖ ਕੇ ਹੀ ਪਤਾ ਲੱਗਦਾ ਹਾਂਜੀ ਹਾਂਜੀ ਪੈ ਕੇ ਟੇਢੀਆਂ ਜਿਹੜੀਆਂ ਹਾਂ ਅਰਾਮ ਕੁਰਸੀ ਕਹਿ ਦਿੰਦੇ ਸੀ ਉਹਨਾਂ ਨੂੰ ਅੱਗੇ ਹਾਂ ਹੈਗੀ ਆ ਹਾਂ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ